ਹੈਲੋ ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਮੈਮ ਅੱਛਾ ਜੀ ਸਵੇਰੇ ਤਾਂ ਠੀਕ ਠਾਕ ਗਿਆ ਮੈਮ ਉਹਨੇ ਖਾਣਾ ਵੀ ਸਹੀ ਖਾਇਆ ਸਾਰਾ ਕੁਛ ਸਹੀ ਸੀ ਅੱਛਾ ਅੱਛਾ ਹਾਂਜੀ ਹਾਂਜੀ ਅੱਛਾ ਮੈਮ ਅਤੇ ਤੁਸੀਂ ਉਹਨੂੰ ਕੁਛ ਖਾ ਪੁਆ ਪਿਆ ਦੇਣਾ ਸੀ ਮੈਮ ਉਸ ਤੋਂ ਬਾਅਦ ਦਵਾਈ ਦੇ ਦਿੰਦੇ ਉਹਨੂੰ ਅੱਛਾ ਜੀ ਅੱਛਾ ਜੀ ਅਤੇ ਮੈਂ ਤਾਂ ਮੈਮ ਅਜੇ ਹੈ ਨਹੀਂ ਸੀਗੀ ਘਰ ਫਿਰ ਜੇ ਤੁਹਾਡੇ ਚੋਂ ਉੱਧਰੋਂ ਕੋਈ ਇਹਨਾਂ ਨੂੰ ਘਰ ਛੱਡ ਜਾਣ ਹਾਂਜੀ ਅਤੇ ਜੇ ਮੈਂ ਨਾ ਆਵਾਂ ਮੈਮ ਫਿਰ ਤੁਸੀਂ ਕਿਸੇ ਹੋਰ ਦੇ ਹੱਥ ਫਿਰ ਭੇਜ ਦੋਂਗੇ ਇੱਦਾਂ ਬੱਚੇ ਨੂੰ ਹਾਂਜੀ ਹਾਂ ਜਾਂ ਮੈਨੂੰ ਦੱਸ ਦਿਉ ਮੈਮ ਕਿ ਪਰਿਵਾਰ ਦਾ ਹੋਰ ਕਿਹੜਾ ਮੈਂਬਰ ਲੈਣ ਲਈ ਆ ਸਕਦਾ ਜੇ ਮੈਂ ਨਾ ਆ ਆ ਸਕਦੀ ਹਾਂ ਹਾਂਜੀ ਹਾਂ ਠੀਕ ਹੈ ਮੈਂ ਦਫਤਰ 'ਤੇ ਜਿਹੜਾ ਤੁਹਾਡਾ ਮੇਨ ਆ ਉੱਥੇ ਮੈਂ ਗੱਲ ਕਰ ਲਾਂਗੀ ਕੋਈ ਨਹੀਂ ਹਾਂਜੀ ਹਾਂ ਅਤੇ ਤੁਸੀਂ ਦਵਾਈ ਕਿੰਨੇ ਟਾਈਮ ਦਵਾਈ ਹੈ ਮੈਮ ਇਹਨੂੰ ਪਹਿਲਾਂ ਕਿੰਨੇ ਟਾਈਮ ਦਿੱਤੀ ਆ ਹੁਣ ਅੱਛਾ ਅੱਛ ਅਤੇ ਉਹਦੇ ਨਾਲ ਬੁਖਾਰ ਬਿਲਕੁਲ ਵੀ ਨਹੀਂ ਉਤਰਿਆ ਇਹਨਾਂ ਦਾ ਅੱਛਾ ਅੱਛਾ ਠੀਕ ਹੈ ਕੋਈ ਗੱਲ ਨਹੀਂ ਮੈਮ ਫਿਰ ਮੈਂ ਲੈਣ ਲਈ ਭੇਜ ਦਿੰਦੀ ਹਾਂ ਇਹਨਾਂ ਨੂੰ ਹਾਂਜੀ ਹਾਂ ਅਤੇ ਫਿਰ ਮੈਂ ਗੱਲ ਕਰ ਲਾਂਗੀ ਫੋਨ 'ਤੇ ਤੁਹਾਡੇ ਨਾਲ ਅਤੇ ਤੁਸੀਂ ਉਹਨਾਂ ਹੱਥ ਭੇਜ ਦਿਓ ਮੈਂ ਨਾਮ ਵੀ ਲਿਖ ਦੂੰਗੀ ਉਹਨਾਂ ਦਾ ਕਿ ਬੱਚੇ ਦਾ ਮੇਰੇ ਦਾ ਕੀ ਨਾਂ ਹੈ ਕਿਹੜੀ ਕਲਾਸ ਹੈ ਫਿਰ ਤੁਸੀਂ ਭੇਜ ਦਿਓ ਫਿਰ ਮੈਂ ਇਹਨਾਂ ਨੂੰ ਚੈੱਕਅਪ ਕਰਾਵਾਂਗੀ ਹਾਂਜੀ ਠੀਕ ਹੈ ਮੈਮ ਜੀ ਧੰਨਵਾਦ ਜੀ ਤੁਹਾਡਾ ਸਤਿ ਸ਼੍ਰੀ ਅਕਾਲ ਜੀ